ਸਾਡੇ ਕਾਲਜ ਮੀਆਂ ਨੇ ਅਸੀਂ ਉਹਨਾਂ ਨੂੰ ਦੇਖਭਾਲ ਕਰਦੇ ਹਾਂ ਪਹਿਲੇ ਉਹਨਾਂ ਨੂੰ ਵਾਹੁੰਦੇ ਹਾਂ ਅ ਹਲ ਨਾਲ ਵਾਹੁੰਦੇ ਹਾਂ ਫਿਰ ਅਸੀਂ ਸੁਹਾਗਿਆਂ ਨਾਲ ਵਾਹੁੰਦੇ ਹਾਂ ਹਾਂ ਫਿਰ ਅਸੀਂ ਉਹ ਕਰਦੇ ਹਾਂ ਆਰੰਭੀਆਂ ਨਾਲ ਗੋਡੀਆਂ ਕਰਦੇ ਹਾਂ ਇਹ ਕੁਛ ਕਰਕੇ ਫਿਰ ਫ਼ਸਲ ਤਿਆਰ ਫ਼ਸਲ ਸ ਅ ਬੀਜ ਪਾਉਂਦੇ ਹਾਂ ਵੀ ਪਾ ਕੇ ਫਿਰ ਫ਼ਸਲ ਹੁੰਦੀ ਹੈ ਫਿਰ ਦਾਤਰੀਆਂ ਨਾਲ ਉਹਨੂੰ ਸਾਫ਼ ਸਫਾਈ ਕਰ ਕਦੇ ਘਾਹ ਬੂਟਾ ਕੱਢਦੇ ਹਾਂ ਅਤੇ ਪਾਣੀ ਦੇਣ ਲਈ ਮੋਟਰਾਂ ਲਾਈ ਦੀਆਂ ਨੇ ਸਭ ਕੁਛ ਕੀਤੇ ਦਾ ਉੱਥੇ ਹੈ ਅਤੇ ਸਾਨੂੰ ਕੋਈ ਅ ਕਿਸੇ ਚੀਜ਼ ਦੀ ਕਮੀ ਨਹੀਂ ਹੈ ਪੈਲੀਆਂ ਸਾਡੀਆਂ ਬਹੁਤ ਨੇ ਕਿੰਨੇ ਕਿੰਨੇ ਕਿੱਲੇ ਪੈਲੀਆਂ ਨੇ ਸਾਡੀਆਂ ਅੱਛਿਆ ਆਹੋ ਸਪਰਿੰਗ ਲਾਏ ਦੇ ਨੇ ਪਾਣੀ ਦੇ ਪਾਣੀ ਦੇ ਸਾਨੂੰ ਕਿਸੇ ਕਿਸਮ ਦੀ ਦਿੱਕਤ ਕੋਈ ਨਹੀਂ ਹੈ ਟਰੈਕਟਰਾਂ ਨਾਲ ਵਾਹੁੰਦੇ ਹਾਂ ਫ਼ਸਲਾਂ ਵੱਢ ਲੈਂਦੇ ਹਾਂ ਸਾਨੂੰ ਕੋਈ ਕਿਸੇ ਕਿਸਮ ਦਾ ਕਸ਼ਟ ਨਹੀਂ ਹੈ ਹੋਰ ਵੀ ਹੋਰ ਵੀ ਈਸਟ ਬਹੁਤ ਸਹੂਲਤਾਂ ਗੌਰਮੈਂਟ ਨੇ ਦਿੱਤੇ ਦੀਆਂ ਅਸੀਂ ਉਹਨਾਂ ਨਾਲ ਫ਼ਸਲ ਤਿਆਰ ਕਰਨ ਲੈਂਦੇ ਹਾਂ ਕੋਲ ਹੱਲ ਵੀ ਹੈ ਟਰੈਕਟਰ ਵੀ ਹਨ ਸਭ ਕੁਛ ਹੈ ਅਸੀਂ ਉਹਨਾਂ ਨਾਲ ਵਾਹ ਕੇ ਕਰ ਲੈਂਦੇ ਹਾਂ